ਹੈਲੋ ਰਾਜਾ ਟਰਾਂਸਪੋਰਟ ਕੰਪਨੀ ਹਾਂਜੀ ਕੌਣ ਬੋਲ ਰਹੇ ਨੇ ਹਾਂਜੀ ਦਿਲਬਾਗ ਜੀ ਤੁਸੀਂ ਬੋਲ ਰਹੇ ਹੋ ਹਾਂਜੀ ਦਿਲਬਾਗ ਜੀ ਮੈਂ ਆਪ ਜੀ ਦਾ ਪੁਰਾਣਾ ਕਸਟਮਰ ਬੋਲ ਰਿਹਾ ਹਾਂ ਦਿਲਬਾਗ ਜੀ ਮੈਨੂੰ ਤੁਹਾਡੀ ਇੱਕ ਕੈਬ ਦੀ ਲੋੜ ਹੈਗੀ ਆ ਮੈਂ ਅ ਆਪ ਜੀ ਦੇ ਕੈਬ ਰਾਹੀਂ ਮੇਰੇ ਦੋਸਤ ਆ ਰਹੇ ਹਨ ਅਤੇ ਮੈਂ ਉਹਦੇ ਵਿੱਚ ਬਾਘਾ ਬਾਰਡਰ ਤ ਏਅਰਪੋਰਟ ਰੋਡ ਅਤੇ ਕੁਛ ਗੁਰਦੁਆਰਿਆਂ ਦਾ ਸ ਜ ਜਾਣ ਦਾ ਇਰਾਦਾ ਬਣਾਇਆ ਹੈ ਅਤੇ ਆਪ ਜੀ ਦੀ ਕੈਬ ਦਾ ਮ ਮੇਰੇ ਮੋਬਾਈਲ ਉੱਤੇ ਕਾਫੀ ਔਫਰ ਆ ਰਿਹਾ ਹੈ ਤੁਸੀਂ ਜ਼ਰੂਰ ਦੱਸੋ ਕੀ ਕਿ ਤੁਸੀਂ ਮੈਨੂੰ ਕਿੰਨਾ ਕੁ ਡਿਸਕਾਊਂਟ ਦੇਵੋਗੇ ਕਿ ਤਾਂ ਜੋ ਮੈਂ ਅਪ ਮੈਂ ਆਪਣਾ ਤੁਹਾਡੇ ਨਾਲ ਫਾਈਨਲ ਕਰ ਸਕਾਂ ਕਿ ਮੈਂ ਤੁਹਾਡੀ ਕੈਪ ਕ ਕੈਪ ਹੀ ਕਰਾ ਕੇ ਜਾਵਾਂ ਕਿਉਂਕਿ ਤੁਹਾਡੀ ਤੁਹਾਡਾ ਮੈਂ ਕਾਫੀ ਪੁਰਾਣਾ ਕਸਟਮਰ ਆ ਅਤੇ ਤੁਹਾਡੀ ਕੈਬ ਮੈਂ ਆ ਆਰ ਆ ਹਮੇਸ਼ਾ ਹੀ ਲੈ ਕੇ ਜਾਂਦਾ ਹਾਂ ਕਦੀ ਕਿਉਂਕਿ ਮੇਰੀ ਆਪਣੀ ਫੀਲਡ ਜੋਬ ਹੈ ਅਤੇ ਫੀਲਡ ਜੋਬ ਦੇ ਨਾਲ ਮੈਂ ਕਈ ਵਾਰੀ ਤੁਹਾਡੇ ਨਾਲ ਫੈਮਿਲੀ ਅਤੇ ਦੋਸਤਾਂ ਨਾਲ ਵੀ ਗਿਆ ਹਾਂ ਅਤੇ ਤ ਤ ਮੈਨੂੰ ਤੁਹਾਡੇ ਨਾਲ ਸਫ਼ਰ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਕ ਤੁਸੀਂ ਮੈਨੂੰ ਜ਼ਰੂਰ ਆਪਣੀ ਕੈਬ ਦੇਵੋ